ਹੈਲੋ ਹਾਂਜੀ ਭਾਅ ਜੀ ਕਿਆ ਹਾਲ ਆ ਜੀ ਠੀਕ ਹੋ ਬਸ ਠੀਕ ਆ ਭਾਅ ਜੀ ਚੱਲੀ ਚੱਲੀ ਜਾਂਦਾ ਪਰ ਪਰੇਸ਼ਾਨ ਬੜੇ ਹਾਂ ਕਪੂਰਥਲਾ ਦੇ ਨਾ ਹਾਲਾਤਾਂ ਤੋਂ ਬੜੇ ਪਰੇਸ਼ਾਨ ਹਾਂ ਇੱਥੋਂ ਦੇ ਟਰੈਫਿਕ ਤੋਂ ਬੜੇ ਪਰੇਸ਼ਾਨ ਹਾਂ ਸਹੀ ਗੱਲ ਆ ਸਰ ਕੱਲ੍ਹ ਮੈਂ ਕਵੋ ਉੱਧਰੋਂ ਰਮਣੀਕ ਚੌਂਕ ਤੋਂ ਆ ਰਿਹਾ ਜੀ ਅਤੇ ਅੱਧਾ ਘੰਟਾ ਮੈਂ ਉੱਥੇ ਟਰੈਫਿਕ 'ਚ ਬਾਈਪਾਸ ਕੋਲ ਖੜ੍ਹੇ ਰਿਹਾ ਨਾ ਉੱਥੇ ਕੋਈ ਟਰੈਫਿਕ ਪੁਲਿਸ ਨਾ ਕੋਈ ਕੋਈ ਪੁਲਿਸ ਦੂਜੀ ਪੁਲਿਸ ਵੀ ਨਹੀਂ ਕਿ ਜਿਹੜੀ ਆ ਕੇ ਟਰੈਫਿਕ ਖੁਲ੍ਹਾਣ 'ਚ ਮਦਦ ਕਰ ਸਕੇ ਮਤਲਬ ਕੋਈ ਵੀ ਨਹੀਂ ਸੀਗਾ ਬਸ ਫਿਰ ਬਾਅਦ 'ਚ ਇੱਕ ਬੰਦਾ ਪਤਾ ਨਹੀਂ ਕਿੱਥੋਂ ਦੀ ਰੱਬ ਵਾਂਗੂ ਪ੍ਰਗਟ ਹੋਇਆ ਜੀ ਜਿਹਨੇ ਉੱਥੇ ਲੋਕਾਂ ਨੂੰ ਸੀਟੀ ਜੀ ਪਤਾ ਨਹੀਂ ਕਿੱਥੋਂ ਮਾਰ ਮਾਰ ਕੇ ਉਹਨੇ ਵਿਚਾਰੇ ਨੇ ਗੱਡੀਆਂ ਗੁਡੀਆਂ ਹੱਥ ਨਾਲ ਅੱਗੇ ਪਿੱਛੇ ਕਰਾ ਕਰੂ ਕੇ ਕੱਢੀਆਂ ਨਹੀਂ ਤਾਂ ਬਹੁਤ ਬੁਰਾ ਹਾਲ ਸੀ ਮੈਨੂੰ ਲੱਗਦਾ ਘੰਟੇ ਤੋਂ ਪਹਿਲਾਂ ਤਾਂ ਮੈਂ ਉੱਥੋਂ ਦੀ ਨਿਕਲ ਹੀ ਨਹੀਂ ਸਕਦਾ ਸੀ ਬਹੁਤ ਬੁਰਾ ਹਾਲ ਸਹੀ ਗੱਲ ਆ ਸਹੀ ਗੱਲ ਆ ਸਰ ਕਿਤੇ ਬੈਰੀਕੇਡ ਲਾ ਦੇਣ ਹਾਂਜੀ ਹਾਂਜੀ ਜੀ ਜੀ ਜਿੱਥੇ ਜਿੱਥੇ ਭੀੜੇ ਜਿੱਥੇ ਭੀੜੇ ਬਜ਼ਾਰ ਆ ਉੱਥੇ ਇਹਨਾਂ ਨੂੰ ਬੈਰੀਕੇਡ ਲਾ ਕੇ ਵੱਡੀਆਂ ਗੱਡੀਆਂ ਰੋਕ ਦੇਣੀਆਂ ਚਾਹੀਦੀਆਂ ਉੱਥੇ ਸਿਰਫ ਠੀਕ ਹੈ ਚਲੋ ਠੀਕ ਹੈ